ਪੁਰਾਣੇ ਸਮੇਂ ਵਿੱਚ ਪੰਜਾਬੀ ਗਿੱਧਾ ਭੰਗੜਾ ਬਹੁਤ ਹੀ ਕਰਦੇ ਹੁੰਦੇ ਸੀ ਇਸ ਜ਼ਮਾਨੇ ਵਿੱਚ ਤਾਂ ਲੋਕ ਗਿੱਧਾ ਭੰਗੜਾ ਕਰਦੇ ਹੀ ਨੇ ਇਸ ਵਿੱਚ ਤਾਂ ਡਾਂਸ ਹੀ ਕਰਦੇ ਹਨ ਪਤਾ ਨਹੀਂ ਕੀ ਕੀ ਕਰਦੇ ਰਹਿੰਦੇ ਹਨ ਪੁਰਾਣੇ ਜ਼ਮਾਨੇ ਵਿੱਚ ਤਾਂ ਭੰਗੜਾ ਅਤੇ ਗਿੱਧਾ ਹੀ ਕਰਦੇ ਸਨ ਪੰਜਾਬੀ ਪੰਜਾਬੀ ਸੱਭਿਆਚਾਰ ਦੀ ਇਸ ਨਾਲ ਇਸ ਨਾਲ ਪਹਿਚਾਣ ਹੁੰਦੀ ਸੀ ਪੰਜਾਬੀ ਸੱਭਿਆਚਾਰਾਂ ਦੀ ਇਹ ਭੰਗੜੇ ਡਾਂਸ ਤੋਂ ਪਹਿਚਾਣ ਹੁੰਦੀ ਸੀ ਹੁਣ ਤਾਂ ਪਤਾ ਨਹੀਂ ਲੋਕ ਨਾਚ ਕੀ ਕਰਦੇ ਰਹਿੰਦੇ ਹਨ ਸਾਨੂੰ ਇਸ ਦਾ ਬਹੁਤ ਹੀ ਵਧੀਆ ਨਹੀਂ ਲੱਗਦਾ ਸਾਨੂੰ ਤਾਂ ਆਪਣੇ ਪੰਜਾਬੀ ਲੋਕ ਗੀਤ ਹੀ ਵਧੀਆ ਲੱਗਦੇ ਹਨ ਗਿੱਧਾ ਭੰਗੜਾ ਹੀ ਵਧੀਆ ਲੱਗਦੇ ਹਨ ਅੱਜ ਕੱਲ੍ਹ ਤਾਂ ਪਤਾ ਨਹੀਂ ਲੋਕ ਕੀ ਕਰਦੇ ਰਹਿੰਦੇ ਹਨ ਧੰਨਵਾਦ